ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਅਤੇ ਤੁਸੀਂ ਸ਼ਰਮਾ ਫੀਡ ਭੰਡਾਰ ਤੋਂ ਬੋਲ ਰਹੇ ਹੋ ਅਤੇ ਵੀਰ ਜੀ ਮੈਂ ਨਾ ਤੁਹਾਡੇ ਤੋਂ ਬੀਜ਼ਾਂ ਬਾਰੇ ਪੁੱਛਣਾ ਸੀ ਮੇਰੀ ਨਾ ਮਤਲਬ ਸਾਡੀ ਨਰਮੇ ਦੀ ਫਸਲ ਨਾ ਪਿਛਲੇ ਵਾਰੀ ਵੀ ਬਹੁਤ ਖਰਾਬ ਹੋ ਗਈ ਸੀ ਤਾਂ ਇਸ ਕਰਕੇ ਮੈਨੂੰ ਤੁਹਾਡੇ ਬਾਰੇ ਕਿਸੇ ਨੇ ਦੱਸਿਆ ਸੀ ਵੀ ਉਹਨਾਂ ਨੂੰ ਪੁੱਛ ਲਓ ਅਤੇ ਮੈਂ ਤੁਹਾਡੇ ਤੋਂ ਵੀ ਇਹ ਪੁੱਛਣਾ ਚਾਹੁੰਦੀ ਹਾਂ ਵੀ ਕਿਹੜੇ ਬੀਜ਼ ਵਧੀਆ ਹੁੰਦੇ ਆ ਵੀ ਜਿਹਦੇ ਨਾਲ ਇਸ ਵਾਰ ਸਾਡੀ ਫਸਲ ਖਰਾਬ ਨਾ ਹੋਵੇ ਹੈ ਨਾ ਅੱਛਾ ਜੀ ਹਾਂਜੀ ਅੱਛਾ ਅੱਛਾ ਅਤੇ ਹਾਂਜੀ ਜੇ ਇਸੇ ਕੰਪਨੀ ਦੇ ਹੀ ਹੈ ਕਿ ਹੋਰ ਵੀ ਕੰਪਨੀਆਂ ਦੇ ਹੈਗੇ ਆ ਬੀਜ਼ ਅੱਛਾ ਚੱਲੋ ਬਸ ਸਾਨੂੰ ਇਹ ਹੀ ਹੈ ਵੀ ਵਧੀਆ ਹੋਵੇ ਹੈ ਨਾ ਤਾਂ ਕਿ ਸਾਨੂੰ ਕੋਈ ਦਿੱਕਤ ਨਾ ਆਵੇ ਇਸ ਵਾਰ ਮੈਂ ਤੁਹਾਡੀ ਦੁਕਾਨ ਦਾ ਬਹੁਤ ਨਾਮ ਸੁਣਿਆ ਹੋਇਆ ਵੀ ਵਧੀਆ ਹੁੰਦੇ ਆ ਤੁਹਾਡੇ ਬੀਜ਼ ਤਾਂ ਅੱਛਾ ਅਤੇ ਬਾਕੀ ਤੁਹਾਡੀ ਸ਼ੋਪ ਸੰਡੇ ਨੂੰ ਵੀ ਖੁੱਲ੍ਹੀ ਹੁੰਦੀ ਆ ਅੱਛਾ ਸ਼ਾਮ ਨੂੰ ਪੰਜ ਵਜੇ ਤੱਕ ਚੱਲੋ ਠੀਕ ਹੈ ਜੀ ਅਸੀਂ ਜ਼ਰੂਰ ਵਿਜਿਟ ਕਰਾਂਗੇ ਤੁਹਾਡੇ ਕੋਲ ਅਤੇ ਸਾਨੂੰ ਵਧੀਆ ਦਿਆ ਜੇ ਵਧੀਆ ਕੰਪਨੀ ਦੇ ਬੀਜ਼ ਠੀਕ ਹੈ ਹਾਂਜੀ ਠੀਕ ਹੈ ਵੀਰ ਜੀ